ਮੈਂ ਸ਼੍ਰੀ ਅੰਮ੍ਰਿਤਸਰ ਸ਼ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਰਾ ਜਨਮ ਸ਼੍ਰੀ ਅੰਮ੍ਰਿਤਸਰ ਸ਼ਹਿਰ ਵਿਖੇ ਹੀ ਹੋਇਆ ਹੈ ਮੈਨੂੰ ਸਾਈਕਲ ਚਲਾਉਣ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਕ ਸੀ ਮੈਂ ਸਕੂਲ ਸਾਈਕਲ 'ਤੇ ਹੀ ਆਉਂਦੀ ਅਤੇ ਜਾਂਦੀ ਸੀ ਮੈਂ ਪਲੱਸ ਟੂ ਤੱਕ ਸਾਈਕਲ 'ਤੇ ਹੀ ਸਕੂਲ ਆਉਂਦੀ ਜਾਂਦੀ ਰਹੀ ਅਸੀਂ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਸਾਈਕਲ 'ਤੇ ਹੀ ਘੁੰਮਣ ਜਾਂਦੇ ਸੀ ਅਤੇ ਜੋ ਕਿ ਬਹੁਤ ਮਜ਼ਾ ਆਉਂਦਾ ਸੀ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਵੀ ਡੇਲੀ ਸਾਈਕਲ 'ਤੇ ਹੀ ਆਉਂਦੇ ਅਤੇ ਜਾਂਦੇ ਸੀ ਜੋ ਕਿ ਬੜਾ ਹੀ ਵਧੀਆ ਲੱਗਦਾ ਸੀ ਜਿਸ ਦੇ ਨਾਲ ਸਾਨੂੰ ਦਰਸ਼ਨ ਵੀ ਹੋ ਜਾਂਦੇ ਸੀ ਕਿਤੇ ਸਾਡੀ ਸਰੀਰਿਕ ਐਕਸਰਸਾਈਜ਼ ਵੀ ਹੋ ਜਾਂਦੀ ਸੀਗੀ ਅਸੀਂ ਸਾਰੇ ਹੀ ਇਕੱਠੇ ਹੋ ਕੇ ਸਾਈਕਲ 'ਤੇ ਜਾਂਦੇ ਸੀ